ਮੈਨੂੰ ਮੇਰੇ ਮਨਪਸੰਦ ਦੀਆਂ ਜਿਹੜੀਆਂ ਥਾਂਵਾਂ ਨੇ ਚੰਡੀਗੜ੍ਹ ਹਰਮੰਦਰ ਸਾਹਿਬ ਟਿੱਬੀ ਸਾਹਿਬ ਭੱਠਾ ਸਾਹਿਬ ਅਤੇ ਇੱਥੇ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਬੜਾ ਸਕੂਨ ਮਿਲਦਾ ਹੈ ਗੁਰੂ ਸਾਹਿਬ ਦੀ ਬਾਣੀ ਪੜ੍ਹ ਕੇ